ਡਾਂਸ ਵਿੱਚ ਬਚਪਨ ਤੋਂ ਹੀ ਮੈਨੂੰ ਬਹੁਤ ਵੱਧ ਸਭ ਤੋਂ ਵੱਧ ਰੁਚੀ ਸੀਗੀ ਬਚਪਨ ਤੋਂ ਹੀ ਮੈਂ ਡਾਂਸ ਕਰਨਾ ਬਹੁਤ ਜ਼ਿਆਦਾ ਪਸੰਦ ਕਰਦੀ ਸੀ ਸਭ ਤੋਂ ਪਹਿਲਾਂ ਮੈਨੇ ਡਾਂਸ ਅ ਅ ਮੈਨੇ ਸਕੂਲ ਦੇ ਸਮੇਂ ਵਿੱਚ ਆਪਣੀ ਪੰਜਵੀਂ ਜਮਾਤ ਵਿੱਚ ਆਪਣੇ ਐਨੂਆਲ ਡੇ 'ਤੇ ਫੰਕਸ਼ਨ ਦੇ ਦੌਰਾਨ ਕੀਤੀ ਸੀ ਅਤੇ ਫ ਇਸ ਵਿੱਚ ਫੰਕਸ਼ਨ ਦੇ ਵਿੱਚ ਮੈਂ ਕੀ ਨੇ ਇੱਕ ਪੰਜਾਬੀ ਗਾਣੇ ਦੇ ਉੱਤੇ ਪਰਫੋਰਮੈਂਸ ਕੀਤੀ ਸੀ ਅਤੇ ਇਸ ਪਰਫੋਰਮੈਂਸ ਦੇ ਨਾਲ ਮੈਨੇ ਜੋ ਕਿ ਡਾਂਸ ਕੋਂਪਟੀਸ਼ਨ ਦੇ ਵਿੱਚ ਪਹਿਲੇ ਸਥਾਨ ਪ੍ਰਾਪਤ ਕੀਤਾ ਸੀ ਅਤੇ ਇਸ ਨਾਲ ਮੈਨੂੰ ਮੇਰੇ ਘਰਦਿਆਂ ਨੇ ਅਤੇ ਮੇਰੇ ਅਧਿਆਪਿਕਾ ਨੇ ਬਹੁਤ ਜ਼ਿਆਦਾ ਸਰਾਹਿਆ ਅਤੇ ਇਸ ਸਰਾਹਨਾ ਦੇ ਕਰਕੇ ਹੀ ਮੇਰਾ ਅ ਡਾਂਸ ਦੇ ਵਿੱਚ ਹੋਰ ਵੀ ਜ਼ਿਆਦਾ ਰੁਚੀ ਵੱਧ ਗਈ ਅਤੇ ਮੈਨੇ ਆਪਣੇ ਸਕੂਲ ਦੇ ਸਮੇਂ ਵੱਡੀਆਂ ਕਲਾਸਾਂ ਅਤੇ ਹੋਰ ਕਾਲਜਾਂ ਦੇ ਵਿੱਚ ਵੀ ਡਾਂਸਾਂ ਅਤੇ ਬਹੁਤ ਜ਼ਿਆਦਾ ਪਰਫੋਰਮਸ ਦਿੱਤੀਆਂ ਅਤੇ ਇਸ ਨਾਲ ਮੈਂ ਬੋ ਹੋਰ ਵੀ ਕਈ ਵਿਸ਼ੇਸ਼ ਮੌਕਿਆਂ ਉੱਤੇ ਡਾਂਸ ਕੀਤਾ ਜਿਵੇਂ ਕਿ ਪੰਦਰਾਂ ਜਨਵਰੀ ਪੰਦਰਾਂ ਅਗਸਤ ਅਤੇ ਛੱਬੀ ਜਨਵਰੀ ਵਰਗੇ ਵਿਸ਼ੇਸ਼ ਮੌਕਿਆਂ 'ਤੇ ਵੀ ਮੈਂ ਗਿੱਧਾ ਵਗੈਰਾ ਕਰਦੀ ਹੁੰਦੀ ਸੀ ਅਤੇ ਜਿਸ ਨਾਲ ਮੈਨੂੰ ਮੇਰੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਸੀ